ਫਤਿਹਗੜ੍ਹ ਸਾਹਿਬ ਵਿੱਚ ਕਾਫੀ ਵਧੀਆ ਵਧੀਆ ਗੇਮਾਂ ਖਿਡਾਈਆਂ ਜਾਂਦੀਆਂ ਹਨ ਜਿਵੇਂ ਕਿ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕੋਲਜ ਦੀ ਜੋ ਗਰੋਂਡ ਹੈ ਉਸ ਵਿੱਚ ਕ੍ਰਿਕਟ ਅਤੇ ਬੈਡਮਿੰਟਨ ਦਾ ਬਹੁਤ ਵਧੀਆ ਪਲੇਅ ਗਰਾਉਂਡ ਬਣਾਇਆ ਹੋਇਆ ਬੱਚੇ ਈਵਨਿੰਗ ਟਾਈਮ 'ਤੇ ਅ ਆ ਕੇ ਆਪਣਾ ਰਿਹੱਸਲ ਕਰਦੇ ਨੇ ਕੁਛ ਸਰਕਾਰੀ ਕਰਮਚਾਰੀ ਜਿਵੇਂ ਕਿ ਪੁਲਿਸ ਦੇ ਕਰਮਚਾਰੀ ਨੇ ਸਪੋਰਟਸ ਵਿੱਚ ਜੋ ਬਹੁਤ ਵਧੀਆ ਨੇ ਉਹਨਾਂ ਨੂੰ ਇਹਨਾਂ ਦੇ ਵਿੱਚ ਫ੍ਰੀ ਟਾਈਮ ਦਿੱਤਾ ਹੁੰਦਾ ਵੀ ਤੁਸੀਂ ਬੱਚਿਆਂ ਨੂੰ ਵਧੀਆ ਤੋਂ ਵਧੀਆ ਗੇਮਾਂ ਖਿਡਾਓ ਉਹਨਾਂ ਨੂੰ ਡਿਸਟ੍ਰਿਕ ਲੈਵਲ ਸਟੇਟ ਲੈਵਲ 'ਤੇ ਲੈ ਕੇ ਜਾਓ ਔਰ ਵਧੀਆ ਇੱਕ ਅ ਖਿਡਾਰੀਆਂ ਦੀ ਚੁਣੌਤੀ ਪੂਰੀ ਕਰਦੇ ਨੇ ਉਹ ਈਵਨਿੰਗ ਡੇਲੀ ਰੂਟੀਨ ਸ਼ਾਮ ਨੂੰ ਚਾਰ ਤੋਂ ਸੱਤ ਵਜੇ ਦੇ ਵਿੱਚ ਵਿੱਚ ਆਉਂਦੇ ਨੇ ਉਹ ਫ੍ਰੀ ਆਫ ਕੋਸਟ ਆ ਜੋ ਵੀ ਬੱਚਾ ਉਹਦੇ ਵਿੱਚ ਚਾਹਵਾਨ ਆ ਤਾਂ ਆਪਣਾ ਗੇਮਾਂ ਵਿੱਚ ਪਾਰਟੀਸਪੇਟ ਕਰ ਲੈਂਦਾ ਹੈ